ਹਾਂਜੀ ਮੈਡਮ ਨਮਸਕਾਰ ਹਾਂਜੀ ਮੈਡਮ ਮੈਂ ਇੰਟਰਨੈੱਟ ਕੰਪਨੀ ਤੋਂ ਗੱਲ ਕਰ ਰਿਹਾ ਸੀ ਤੁਸੀਂ ਇੰਟਰਨੈੱਟ ਕਨੈ ਕਨੈਕਸ਼ਨ ਲਗਵਾਉਣਾ ਚਾਹੁੰਦੇ ਹੋ ਜੀ ਹਾਂ ਹਾਂਜੀ ਮੈਡਮ ਇੱਕ ਪੰਜ ਸੌ ਵਾਲਾ ਪਲਾਨ ਹੈ ਜੀ ਇੱਕ ਹਜ਼ਾਰ ਰੁਪਏ ਵਾਲਾ ਇੱਕ ਪੰਦਰਾਂ ਸੌ ਵਾਲਾ ਪਲਾਨ ਹੈ ਜੀ ਤੁਸੀਂ ਕਿਹੜਾ ਪਲਾਨ ਲੈਣਾ ਚਾਹੁੰਦੇ ਹੋ ਓਕੇ ਓਕੇ ਠੀਕ ਹੈ ਜੀ ਮੈਡਮ ਅਸੀਂ ਆਪਣੀ ਕਾਰਵਾਈ ਸ਼ੁਰੂ ਕਰ ਦਿੰਦੇ ਹਾਂ ਤੁਹਾਨੂੰ ਹਜ਼ਾਰ ਰੁਪਏ ਵਾਲਾ ਜਿਹੜਾ ਪਲਾਨ ਹੋਵੇਗਾ ਉਹ ਤੁਹਾਨੂੰ ਸਫੀਸ਼ੈਂਟ ਹੋਵੇਗਾ ਜੀ ਉਸ 'ਚ ਤੁਹਾਨੂੰ ਹਜ਼ਾਰ ਵਿੱਚ ਤੁਹਾਨੂੰ ਫਾਈਵ ਜੀ ਡਾਟਾ ਹੋਵੇਗਾ ਜੀ ਅਤੇ ਅੱਸੀ ਜੀ ਬੀ ਤੱਕ ਤੁਸੀਂ ਯੂਜ਼ ਕਰ ਸਕੋਗੇ ਡਾਟਾ ਨੂੰ ਅਤੇ ਉਸ ਤੋਂ ਬਾਅਦ ਤੁਹਾਡਾ ਪੰਜ ਸੌ ਬਾਰਾਂ ਕੇ ਬੀ ਪੀ ਐਸ ਸਪੀਡ ਆਵੇਗੀ ਜੀ ਤੁਹਾਨੂੰ ਨਹੀਂ ਨਹੀਂ ਮੈਡਮ ਨਹੀਂ ਨੈੱਟ ਬਿਲਕੁਲ ਚੱਲੇਗਾ ਜੀ ਉਹ ਤੁਹਾਨੂੰ ਮੰਥਲੀ ਉਹਦਾ ਆਪਣਾ ਤੁਹਾਨੂੰ ਈਮੇਲ 'ਤੇ ਅਤੇ ਤੁਹਾਡੇ ਆਪਣੇ ਵਟਸਐੱਪ 'ਤੇ ਤੁਹਾਨੂੰ ਉਹਦਾ ਬਿੱਲ ਆ ਜਾਇਆ ਕਰੇਗਾ ਜੀ ਅਤੇ ਤੁਹਾਨੂੰ ਨਹੀਂ ਨਹੀਂ ਜੀ ਸਾਡੇ ਸਾਡੇ ਕੋਲ ਮਕੈਨਿਕ ਹੈ ਜੀ ਤੁਹਾਡੀ ਜਦੋਂ ਵੀ ਕੰਪਲੇਂਟ ਆਵੇਗੀ ਉਹ ਨਾ ਚੌਵੀ ਘੰਟੇ ਦੇ ਅੰਦਰ ਅੰਦਰ ਠੀਕ ਕਰ ਦਿੱਤਾ ਜਾਵੇਗਾ ਤੁਹਾਡੀ ਕੋਈ ਪ੍ਰੋਬਲਮ ਹੋਵੇਗੀ ਠੀਕ ਹੈ ਜੀ ਮੈਂ ਅਸੀਂ ਕੱਲ ਆਵਾਂਗੇ ਤੁਹਾਡੇ ਕੋਲ ਅਤੇ ਫੋਰਮ ਫੂਮ ਵਗੈਰਾ ਤੁਹਾਡਾ ਫਿੱਲ ਕਰ ਲਵਾਂਗੇ ਜੀ ਅਤੇ ਹੋਪਫੁਲੀ ਕੱਲ ਹੀ ਤੁਹਾਡੇ ਨਾ ਚਾਲੂ ਕਰ ਦਾਂਗੇ ਜੀ ਓਕੇ ਜੀ ਮੈਡਮ ਥੈਂਕ ਯੂ ਵੈਰੀ ਮਚ ਹਾਂਜੀ ਹਾਂਜੀ ਠੀਕ ਠੀਕ ਠੀਕ ਕੋਈ ਨਹੀਂ ਅਸੀਂ ਆਪਣੇ ਮਕੈਨਿਕ ਨੂੰ ਕਹਿ ਦਾਂਗੇ ਜੀ ਉਹ ਤੁਹਾਨੂੰ ਤੁਰਨ ਤੋਂ ਪਹਿਲਾਂ ਤੁਹਾਨੂੰ ਕਾਲ ਆਉਣ ਤੋਂ ਪਹਿਲਾਂ ਤੁਹਾਨੂੰ ਕਾਲ ਕਰ ਲੈਣਗੇ ਅਤੇ ਠੀਕ ਹੈ ਜੀ ਕਾਲ ਕਰਕੇ ਤੁਹਾਡੇ ਕੋਲ ਆ ਜਾਣਗੇ ਜੀ ਓਕੇ ਜੀ ਥੈਂਕ ਯੂ ਜੀ ਥੈਂਕ